ਕਾਜੂ ਕਤਲੀ ਬਰਫੀ ਗੁਲਾਬ ਜਾਮਣੀ ਮਰਤੀ ਰਜਗੁੱਲਾ ਰਸਮਲਾਈ ਸੋਨ ਪਾਪੜੀ ਮੋਦਕ ਰਬੜੀ ਬਾਲੂ ਸ਼ਾਹੀ ਬੇਸਣ ਦੇ ਲੱਡੂ ਸ਼੍ਰੀਕਾਂਦ ਹੋ ਗਈ ਬੂੰਦੀ ਹੋ ਗਈ ਕਲਾਕੰਦ ਨਾਨ ਖਟਾਈ